ਭੰਗੜਾ ਐਰੋਬਿਕਸ ਆਪਣੇ ਪ੍ਰਤੀਭਾਗੀਆਂ ਵਿੱਚ ਰਚਨਾਤਮਕਤਾ ਨੂੰ ਭਰਨ ਦੇ ਲਈ ਸੰਗੀਤ ਅਤ ਨੱਚਣ ਦੇ ਜਿਹੜੇ ਆਪਣੇ ਸਟੈਪ ਹੁੰਦੇ ਹੈ ਉਨ੍ਹਾਂ ਨੂੰ ਆਪਸ ਵਿੱਚ ਮਿਲਾਨ ਅ ਕਰਨਾ ਮਤਲਬ ਉਹਦੇ 'ਚ ਜ਼ਰੂਰੀ ਹੁੰਦਾ ਕਿਉਂਕਿ ਜਿਵੇਂ ਦਾ ਮਿਊਜ਼ਿਕ ਹੋਵੇਗਾ ਆਪਾਂ ਓਵੇਂ ਦਾ ਹੀ ਸਟੈਪ ਕਰਾਂਗੇ ਤਾਂ ਫਿਰ ਇਹ ਆਪਾਂ ਨੂੰ ਰਚਨਾਤਮਕ ਬਣਾਉਂਦਾ ਹੈ ਕਿ ਆਪਾਂ ਕਿਸੇ ਸਟੈਪ ਦੇ ਕਿਸੇ ਮਿਊਜ਼ਿਕ ਦੇ ਬਦਲਣ 'ਤੇ ਆਪਣੇ ਸਟੈਪ ਨੂੰ ਕਿਵੇਂ ਚੇਂਜ ਕਰਨਾ ਇਸ ਤਰ੍ਹਾਂ ਮਤਲਬ ਆਪਾਂ ਸੋਚ ਸਕਦੇ ਹਾਂ ਕਿ ਆਪਾਂ ਮਤਲਬ ਕਿਸੇ ਸਿਚੂਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਇਸ ਹਿਸਾਬ ਦੇ ਨਾਲ ਅਤੇ ਕਈ ਵਾਰ ਜਦੋਂ ਆਪਸ ਮੁਕਾਬਲੇ ਹੁੰਦੇ ਹੈ ਭੰਗੜੇ ਵਗੈਰਾ ਦੇ ਤਾਂ ਉਹ ਆਪਸ 'ਚ ਜਿਹੜੇ ਕੰਟੈਸਟੈਂਟ ਹੈ ਉਹ ਮਿਲਾ ਮਤਲਬ ਤਾਲਮੇਲ ਬਣਾਉਂਦੇ ਹੈ ਆਪਸ 'ਚ ਅਤੇ ਆਹ ਚੀਜ਼ ਉਨ੍ਹਾਂ 'ਚ ਮਤਲਬ ਇੱਕ ਤਰੋਂ ਇੱਕ ਤਰ੍ਹਾਂ ਨਾਲ ਉਨ੍ਹਾਂ 'ਚ ਮਤਲਬ ਅ ਕੋਰਡੀਨੇਟ ਬਣਾਉਣ ਦੀ ਕੋਸ਼ਿਸ਼ ਕਰਦਾ ਭੰਗੜੇ ਦੇ ਜਰੀਏ ਅਤੇ ਕੁਛ ਫਿਰ ਜਿਵੇਂ ਆਪਾਂ ਕਹਿ ਦੇਈਏ ਕਿ ਮੂਡ ਅਤੇ ਉਤਸ਼ਾਹ ਨੂੰ ਪ੍ਰਭਾਵਿਤ ਕਰਦਾ ਕਿ ਮੰਨ ਲਓ ਆਪਣਾ ਕਦੇ ਕਿਸੇ ਟਾਈਮ ਮੂਡ ਨਹੀਂ ਵਧੀਆ ਪਰ ਜੇਕਰ ਆਪਾਂ ਮਤਲਬ ਫਿਰ ਵੀ ਧੱਕੇ ਨਾਲ ਵੀ ਜੇਕਰ ਭੰਗੜਾ ਕਰ ਰਹੇ ਹਾਂ ਤਾਂ ਆਟੋਮੈਟਿਕ ਆਪਣਾ ਜਿਹੜਾ ਮੂਡ ਹੈ ਉਹ ਵਧੀਆ ਹੋ ਜਾਂਦਾ ਨ ਮਤਲਬ ਆਪਾਂ ਐਨਰਜੈਟਿਕ ਫੀਲ ਕਰਨ ਲੱਗ ਜਾਂਦੇ ਹਾਂ ਮਤਲਬ ਆਪਣੇ ਮੂਡ ਨੂੰ ਵਧੀਆ ਬਣਾਉਂਦਾ ਜਿਹੜਾ ਭੰਗੜਾ ਹੈ ਅਤੇ ਆਪਣੇ ਜਿਹੜੇ ਅੰਦਰ ਦੇ ਭਾਵ ਹੈ ਉਹ ਆਪਾਂ ਅਪ ਮਤਲਬ ਭੰਗੜੇ ਜਰੀਏ ਜਾਂ ਹੋਰ ਡਾਂਸ ਜਰੀਏ ਆਪਾਂ ਸ਼ੋ ਕਰ ਸਕਦੇ ਹਾਂ ਕਿ ਆਪਾਂ ਇਸ ਟਾਈਮ ਕੀ ਸੋਚ ਰਹੇ ਹਾਂ ਜਾਂ ਕਿਸ ਤਰ੍ਹਾਂ ਦਾ ਸਾਡਾ ਮੂਡ ਹੈ ਅਤੇ ਸਰੀਰਿਕ ਅਤੇ ਮਾਨਸਿਕ ਲਚਕੀਲਾਪਨ ਵੀ ਪੈਦਾ ਕਰਦਾ ਹੈ ਮਤਲਬ ਜਦੋਂ ਆਪਾਂ ਸਟੈਪ ਅ ਮਿਊਜ਼ਿਕ ਦੇ ਅਕੋਡਿੰਗ ਆਪਾਂ ਆਪਣੇ ਸਟੈਪ ਚੇਂਜ ਕਰਦੇ ਹਾਂ ਜਾਂ ਸਰੀਰ 'ਚ ਆਪਾਂ ਮਤਲਬ ਥੋੜ੍ਹਾ ਘੁਮਾਉਣਾ ਮੋਢੇ ਹਿਲਾਉਣਾ ਜਾਂ ਪੈਰਾਂ ਨੂੰ ਚੱਕਣਾ ਅਤੇ ਇਹਦੇ ਨਾਲ ਆਪਣੇ ਸਰੀਰ 'ਚ ਇੱਕ ਲਚਕੀਲਾਪਨ ਆਉਂਦਾ ਹੈ ਸਰੀਰ ਦੀ ਮਤਲਬ ਕਸਰਤ ਕਹਿ ਲਓ ਜਾਂ ਫਿਰ ਇਹਨੂੰ ਆਪਾਂ ਕਸਰਤ ਵੀ ਕਹਿ ਸਕਦੇ ਹਾਂ ਇਸ ਤਰ੍ਹਾਂ ਮਤਲਬ ਤਾਂ ਜਿਹੜਾ ਭੰਗੜਾ ਹੈ ਉਹ ਆਪਣੇ ਰਚਨਾਤਮਕਤਾ ਨੂੰ ਸ਼ੋ ਕਰਦਾ ਹੈ